ਹਾਂ ਕੁਛ ਕੁ ਦਿਨ ਪਹਿਲਾਂ ਨਾ ਮੈਂ ਮੀਸ਼ੋ ਤੋਂ ਕੁੜਤੀ ਮੰਗਵਾਈ ਸੀ ਮੈਨੂੰ ਬਹੁਤ ਵਧੀਆ ਲੱਗੀ ਅਸਲ 'ਚ ਨਾ ਮੈਂ ਔਨਲਾਈਨ ਘੱਟ ਮੰਗਵਾਉਣੀ ਹਾਂ ਕੁਛ ਵੀ ਪਰ ਮੇਰੀ ਫਰੈਂਡਸ ਦੇ ਕਹਿਣ 'ਤੇ ਮੈਂ ਮੰਗਵਾਈ ਉਹ ਕਹਿੰਦੇ ਮੰਗਵਾਇਆ ਕਰ ਵੀ ਬਹੁਤ ਵਧੀਆ ਆਈਟਮਾਂ ਹੁੰਦੀਆਂ ਨੇਗੀਆਂ ਰੇਟ ਵੀ ਠੀਕ ਹੁੰਦੇ ਹੈ ਰਿਟਰਨ ਵੀ ਕਰ ਸਕਦੇ ਹਾਂ ਜੇ ਆਪਾਂ ਨੂੰ ਕੁਛ ਨਹੀਂ ਵਧੀਆ ਲੱਗਦਾ ਅਤੇ ਮੈਂ ਕਿਹਾ ਚੱਲ ਹੋਰ ਤਾਂ ਕੀ ਮੰਗਵਾਉਣਾ ਕੁੜਤੀ ਮੰਗਵਾ ਕੇ ਦੇਖ ਲੈਨੀ ਹਾਂ ਪਰ ਜਦੋਂ ਮੈਂ ਮੰਗਵਾਈ ਇੰਨੀ ਅੱਛੀ ਨਿਕਲੀ ਉਹ ਕੁੜਤੀ ਸਟੱਫ ਵੀ ਅੱਛਾ ਸੀ ਔਰ ਵਾਸ਼ ਕੀਤੇ ਤੋਂ ਵੀ ਨਾ ਕੋਈ ਦਿੱਕਤ ਆਈ ਉਹਦੇ ਵਿੱਚ ਮੈਨੂੰ ਬਹੁਤ ਵਧੀਆ ਲੱਗੀ ਔਰ ਮੇਰੀ ਫਰੈਂਡਸ ਨੇ ਸਾਰਿਆਂ ਨੇ ਮੇਰੇ ਮੰਮੀ ਨੂੰ ਬਹੁਤ ਪਸੰਦ ਆਈ ਮੇਰੇ ਫਰੈਂਡਜ ਨੂੰ ਬਹੁਤ ਪਸੰਦ ਆਈ ਅਤੇ ਉਸ ਤੋਂ ਬਾਅਦ ਮੈਂ ਆਪਣੀ ਸਿਸਟਰ ਨੂੰ ਵੀ ਮੰਗਵਾ ਕੇ ਦਿੱਤੀ ਉਹਦੇ ਨਾਲ ਦੀ ਹਾਂ ਅਤੇ ਮਤਲਬ ਇੰਨੀ ਅੱਛੀ ਲੱਗੀ ਨਾ ਬਹੁਤ ਵਧੀਆ ਹੁਣ ਤਾਂ ਮਤਲਬ ਮੈਨੂੰ ਆਦਤ ਹੀ ਪੈ ਗਈ ਵੀ ਮੰਗਵਾਉਣ ਦੀ ਉਹ ਕੁੜਤੀ ਨੇ ਪਰ ਮੇਰੇ ਦੇਖੋ ਮੈਨੂੰ ਲੱਗਦਾ ਦੋ ਸਾਲ ਹੋ ਗਏ ਹਾਲੇ ਤੱਕ ਨਹੀਂ ਖਰਾਬ ਹੋਈ ਇੰਨੀ ਪਹਿਨਦੀ ਹਾਂ ਮੈਂ ਕਿਤੇ ਵੀ ਜਾਣਾ ਹੁੰਦਾ ਮੇਰੇ ਹੱਥ ਦੇ ਵਿੱਚ ਉਹੀ ਕੁੜਤੀ ਆ ਜਾਂਦੀ ਹੈ ਇੰਨੀ ਕੰਮਫਰਟੇਬਲ ਕੁੜਤੀ ਹੈ ਉਹ ਬਹੁਤ ਜ਼ਿਆਦਾ ਸਭ ਤੋਂ ਵੱਡੀ ਗੱਲ ਔਰੇਂਜ ਕਲਰ ਦੀ ਹੈ ਡਾਰਕ ਕਲਰ ਹੈ ਇੰਨੇ ਉਹਦੇ ਵਿੱਚ ਮੈਨੇ ਮਤਲਬ ਧੋ ਪਾ ਲਿਆ ਇੰਨੀ ਵਾਰ ਉਹਨੂੰ ਵਾਸ਼ ਕਰ ਲਿਆ ਪਰ ਉਹਦਾ ਰੰਗ ਬਿਲਕੁਲ ਵੀ ਨਹੀਂ ਨਿਕਲਿਆ ਹੈਗਾ ਉੱਤੇ ਉਹਦੇ ਜਿਹੜਾ ਵਰਕ ਹੈ ਕਢਾਈ ਹੈ ਸਭ ਕੁਛ ਇੰਨਾਂ ਵਧੀਆ ਉਵੇਂ ਦਾ ਉਵੇਂ ਪਿਆ ਅੱਜ ਵੀ ਜੇ ਉਹਨੂੰ ਪ੍ਰੈਸ ਕਰਕੇ ਰੱਖਦੇ ਨਾ ਐਂ ਲੱਗਦੀ ਹੈ ਵੀ ਉਹ ਨਿਊ ਕੁੜਤੀ ਹੈ ਬਿਲਕੁਲ ਹਾਂ ਅਤੇ ਮੈਨੂੰ ਇੰਨੀ ਵਧੀਆ ਲੱਗਦੀ ਹੈ ਬਹੁਤ ਜ਼ਿਆਦਾ ਵਧੀਆ ਬਹੁਤ ਹੀ ਅੱਛੀ ਕੁੜਤੀ ਹੈਗੀ ਹਾਂ ਹੁਣ ਮੈਂ ਮੰਗਵਾਉਣ ਲੱਗੀ ਮੀਸ਼ੋ ਤੋਂ ਨਹੀਂ ਨਹੀਂ ਬਹੁਤ ਬਹੁਤ ਵਧੀਆ ਸਟੱਫ ਹੈ ਉਹ ਕੁੜਤੀ ਦਾ ਮੇਰੀ ਦਾ ਹਮ ਉਹਦੇ ਨਾਲ ਦੀਆਂ ਤਾਂ ਮੈਨੂੰ ਲੱਗਦਾ ਮੈਂ ਪੰਦਰ੍ਹਾਂ ਵੀਹ ਕੁੜਤੀਆਂ ਮੰਗਵਾ ਤੀਆਂ ਮੇਰੇ ਫਰੈਂਡ ਸਰਕਲ 'ਚ ਸਿਸਟਰਸ ਨੂੰ ਮੰਮਾ ਨੂੰ ਬਹੁਤ ਜ਼ਿਆਦਾ ਹਾਂਜੀ ਹਾਂਜੀ ਓਕੇ